ਮੇਰਾ ਨਾਮ ਅਰਾਧਨਾ ਹੈ ਮੈਂ ਪਠਾਨਕੋਟ ਜ਼ਿਲ੍ਹੇ ਵਿੱਚ ਰਹਿੰਦੀ ਹਾਂ ਅ ਇਸ ਤਰ੍ਹਾਂ ਦਾ ਮੈਂ ਸਾਰਾ ਹੀ ਸਮਾਨ ਆਪ ਹੀ ਜਾ ਕੇ ਬਾਜ਼ਾਰ ਤੋਂ ਲੈ ਕੇ ਆਉਂਦੀ ਹਾਂ ਪਰ ਕੁਛ ਹੀ ਦਿਨ ਪਹਿਲਾਂ ਮੇਰੇ ਘਰ ਮੇਰੇ ਇੱਕ ਸਹੇਲੀ ਆਈ ਅਤੇ ਉਸ ਨੇ ਮੈਨੂੰ ਦੱਸਿਆ ਕਿ ਮੈਂ ਕੁਛ ਸਮਾਨ ਐਮਾਜੋਨ ਤੋਂ ਮੰਗਵਾਇਆ ਹੈ ਉਹ ਸਮਾਨ ਬੜਾ ਹੀ ਚੰਗਾ ਹੈ ਅਤੇ ਮੈਂ ਉਸ ਨੂੰ ਪੁੱਛਿਆ ਕਿ ਜੇਕਰ ਮੈਂ ਵੀ ਮੰਗਵਾਉਣਾ ਚਾਹੁੰਦੀ ਹਾਂ ਤਾਂ ਮੈਨੂੰ ਮਿਲ ਸਕਦਾ ਹੈ ਉਸ ਨੇ ਕਿਹਾ ਇੱਥੋਂ ਕੋਈ ਵੀ ਸਮਾਨ ਮੰਗਵਾ ਸਕਦਾ ਹੈ ਪਰ ਮੈਂ ਉਸ ਨੂੰ ਕਿਹਾ ਕਿ ਮੈਨੂੰ ਇਹ ਸਮਾਨ ਉੱਥੋਂ ਮੰਗਵਾਉਣਾ ਨਹੀਂ ਆਉਂਦਾ ਤਾਂ ਉਸ ਨੇ ਮੈਨੂੰ ਐਮਾਜੋਨ ਬਾਰੇ ਸਭ ਕੁਝ ਦੱਸਿਆ ਅਤੇ ਜਦੋਂ ਮੈਂ ਇਸ ਉਸ ਬਾ ਉਸ ਕੋਲੋਂ ਸਾਰਾ ਕੁਝ ਸਮਝਿਆ ਤਾਂ ਮੈਂ ਵੀ ਉਸ ਤੋਂ ਇੱਕ ਇਹ ਆਪਣਾ ਸਮਾਨ ਮੰਗਾਉਣ ਲਈ ਐਮਾਜੋਨ ਤੋਂ ਐਮਾਜੋਨ ਨੂੰ ਭੇਜਿਆ ਤਾਂ ਉਹ ਉਹਨਾਂ ਨੇ ਮੈਨੂੰ ਇੱਕ ਸਮਾਨ ਜਿਹੜਾ ਮੈਂ ਮੰਗਵਾਇਆ ਸੀ ਉਹ ਭੇਜਿਆ ਜਦੋਂ ਮੈਂ ਉਹ ਆਪਣਾ ਪਾਰਸਲ ਖੋਲ੍ਹਿਆ ਤਾਂ ਉਹ ਇੰਨਾ ਕੁ ਚੰਗਾ ਨਿਕਲਿਆ ਕਿ ਮੈਨੂੰ ਬਹੁਤ ਹੀ ਮਜ਼ਾ ਆਇਆ ਤਾਂ ਮੈਂ ਸੋਚਿਆ ਕਿ ਮੈਂ ਹੁਣ ਕੋਈ ਵੀ ਸਮਾਨ ਮੰਗਵਾਉਣਾ ਹੋਵੇ ਤਾਂ ਮੈਂ ਇਹਨਾਂ ਕੋਲੋਂ ਹੀ ਮੰਗਵਾਮਾ ਕਰਾਂਗੀ ਤਾਂ ਕਿ ਮੈਨੂੰ ਘਰ ਬੈਠੇ ਹੀ ਸਾਰਾ ਕੁਛ ਮਿਲ ਜ ਸਕੇ ਜਦੋਂ ਮੈਂ ਦੂਸਰੀ ਵਾਰ ਆਪਣੇ ਬ ਕੁਛ ਮੰਗਵਾਉਣ ਬਾਰੇ ਸੋਚਿਆ ਤਾਂ ਮੈਂ ਐਮਾਜੋਨ ਨੂੰ ਅਪੀਲ ਕੀਤੀ ਕਿ ਮੈਨੂੰ ਇਹ ਸਮਾਨ ਚਾਹੀਦਾ ਹੈ ਤਾਂ ਉਹਨਾਂ ਨੇ ਇਹ ਸਮਾਨ ਮੇਰਾ ਮਨਜੂਰ ਕਰ ਲਿਆ ਅਤੇ ਥੋੜ੍ਹੇ ਹੀ ਦਿਨਾਂ ਵਿੱਚ ਮੇਰਾ ਪਾਰਸਲ ਘਰ ਪਹੁੰਚ ਗਿਆ ਜਦੋਂ ਮੇਰਾ ਪਾਰਸਲ ਮੁੰਡਾ ਦੇਣ ਆਇਆ ਤਾਂ ਮੈਂ ਉਸ ਕੋਲੋਂ ਪੈਰ ਪਾਰਸਲ ਲੈ ਕੇ ਉਸ ਨੂੰ ਪੈਸੇ ਦਿੱਤੇ ਤਾਂ ਉਸ ਨੇ ਉਹ ਪਾਰਸਲ ਦੇ ਕੇ ਉਹ ਚਲਾ ਗਿਆ ਮੈਂ ਆਪਣੇ ਘ ਅੰਦਰ ਆ ਕੇ ਆਪਣਾ ਪਾਰਸਲ ਖੋਲ੍ਹਿਆ ਤਾਂ ਮੈਂ ਦੇਖਿਆ ਕਿ ਮੇਰਾ ਸਮਾਨ ਇੰਨਾ ਕੁ ਗੰਦਾ ਨਿਕਲਿਆ ਕਿ ਮੇਰਾ ਫਿਰ ਦੁਬਾਰਾ ਉੱਥੋਂ ਸਮਾਨ ਮੰਗਵਾਉਣ ਦਾ ਬਿਲਕੁਲ ਵੀ ਮਨ ਨਹੀਂ ਕੀਤਾ ਅਤੇ ਮੈਨੂੰ ਇਹ ਪ੍ਰੋਡਕਟ ਨਹੀਂ ਅ ਚੰਗਾ ਲੱਗਿਆ ਅਤੇ ਮੇਰਾ ਕੋਈ ਵੀ ਐਮਾਜੋਨ ਤੋਂ ਸਮਾਨ ਮੰਗਵਾਉਣ ਦਾ ਅਨੁਭਵ ਨਹੀਂ ਨਿਕ ਅੱਛਾ ਚੰਗਾ ਨਿਕਲਿਆ